ਦੇਖੋ ਜੀ ਮੈਂ ਖੇਲਦਾ ਰਹਿੰਦਾ ਜੀ ਕਲੱਬਾਂ ਕਨੀ ਤੋਂ ਜਿਵੇਂ ਕੀ ਪਹਿਲੀ ਗੱਲ ਤਾਂ ਇਹ ਜੀ ਇੱਕ ਤਾਂ ਸਾਡੇ ਪਿੰਡ ਦਾ ਕਲੱਬ ਹੈ ਜਿਸ 'ਚ ਕੀ ਪਿੰਡ ਦੇ ਨਾਮ ਦਾ ਮਹਿਰਮਪੁਰ ਯੂਥ ਕਲੱਬ ਹੈ ਜੀ ਉਸ ਵਿੱਚ ਅਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਗੇਮਾਂ ਖੇਡਦੇ ਨੇ ਜੀ ਜੋ ਕੀ ਸਾਡੇ ਲਈ ਬਹੁਤ ਹੀ ਬੈਨੀਫਿਟ ਨੇ ਜਿਵੇਂ ਕੀ ਅਸੀ ਉਸ ਨਾਲ਼ ਇੱਕ ਤਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਨੰਬਰ ਦੋ ਕਲੱਬਾਂ ਨਾਲ ਖੇਡਣ ਦੇ ਫਾਇਦੇ ਬਹੁਤ ਹੁੰਨੇ ਹਨ ਜੀ ਕਿਉਂਕੀ ਜ਼ਿਆਦਾਤਰ ਇਸ 'ਚ ਸਾਨੂੰ ਗੌਰਮੈਂਟ ਦੁਆਰਾ ਫੰਡਿੰਗ ਕੀਤੀ ਜਾਂਦੀ ਹੈ ਜਿਹਦੇ ਨਾਲ ਕੀ ਅਸੀਂ ਈਜੀਲੀ ਸਰਵਾਈਵ ਕਰ ਸਕਦੇ ਹਾਂ ਅਸੀਂ ਆਪਣੀ ਡਾਇਟ ਵਗੈਰਾ ਅਤੇ ਮੈਡੀਕਲ ਸਹੂਲਤਾਂ ਨੂੰ ਪ੍ਰੋਪਰ ਰੱਖ ਸਕਦੇ ਹਾਂ ਜੀ ਅਤੇ ਕਲੱਬ 'ਚ ਖੇਡਣ ਦੇ ਬਹੁਤ ਹੀ ਫਾਇਦੇ ਨੇ ਜਿਵੇਂ ਕੀ ਇਸ ਨਾਲ ਜੀ ਨੈਸ਼ਨਲ ਇੰਟਰਨੈਸ਼ਨਲ ਟੂਰ ਵੀ ਲੱਗ ਸਕਦਾ ਹੈ ਜਿਵੇਂ ਕੀ ਇੱਕ ਸਿਟੀ ਤੋਂ ਦੁਜੀ ਸਿਟੀ ਜਾਂਦੇ ਹਾਂ ਜੀ ਖੇਡਣ ਵਾਸਤੇ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਇਸ ਚੀਜ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਹੈ ਨਾ ਜਿਵੇਂ ਅਸੀਂ ਕਲੱਬਾਂ 'ਚ